ਹੈਲੋ ਸਰ ਕੀ ਮੇਰੀ ਗੱਲ ਕਰੀਏਟਿਵ ਫੂਡਸ ਦੇ ਵਿੱਚ ਹੋ ਰਹੀ ਹੈ ਮੈਂ ਸੁਨਿਧੀ ਬੋਲ ਰਹੀ ਹਾਂ ਮੈਂ ਤੁਹਾਨੂੰ ਥੋੜ੍ਹੀ ਦੇਰ ਪਹਿਲਾਂ ਆਰਡਰ ਦਿੱਤਾ ਸੀਗਾ ਉਸ ਆਰਡਰ ਨੂੰ ਹੈ ਨਾ ਮੈਂ ਥੋੜ੍ਹਾ ਠੀਕ ਕਰਵਾਉਣਾ ਚਾਹੁੰਦੀ ਹਾਂ ਉਹ ਮੇਰੇ ਤੋਂ ਗਲਤੀ ਤੋਂ ਦੇ ਹੋ ਗਿਆ ਉਸ ਆਰਡਰ ਦੇ ਵਿੱਚ ਨਾ ਮੈਂ ਇੰਨਕਲਿਉਡ ਕੀਤੇ ਸੀਗੇ ਦਸ ਬਰਗਰ ਇੰਨਕਲੂਡ ਸੀਗੇ ਦਸ ਪੀਜ਼ਾ ਇੰਨਕਲੂਡ ਸੀਗੇ ਚੀਜ਼ ਬੱਸਟ ਅਤੇ ਦਸ ਥਾਲੀ ਸੀਗੀ ਵੈੱਜ਼ ਥਾਲੀਆਂ ਅਤੇ ਦੋ ਤਰੀਕੇ ਦੇ ਮਿਲਕ ਸ਼ੇਕ ਇੰਨਕਲੂਡ ਕੀਤੇ ਸੀਗੇ ਇੱਕ ਸਟੋਵਰੀ ਇੱਕ ਚੌਕਲੇਟ ਅਤੇ ਹੁਣ ਮੈਂ ਨਾ ਉਹ ਆਰਡਰ ਥੋੜ੍ਹਾ ਠੀਕ ਕਰਵਾਉਣਾ ਚਾਹੁੰਦੀ ਹਾਂ ਆਹ ਵਾਲਾ ਆਰਡਰ ਮੇਰੇ ਤੋਂ ਗਲਤੀ ਤੋਂ ਦੇ ਹੋ ਗਿਆ ਹੁਣ ਵਾਲੇ ਆਰਡਰ 'ਚ ਮੇਰੇ ਪੰਜ ਬਰਗਰ ਅਤੇ ਪੰਜ ਹੀ ਪੀਜ਼ਾ ਰੱਖਿਓ ਚੀਜ਼ ਬੱਸਟ ਅਤੇ ਦੋ ਥਾਲੀ ਕਰ ਦਿਉ ਵੈੱਜ਼ ਅਤੇ ਮਿਲਕ ਸ਼ੇਕ ਤੁਸੀਂ ਦੋਨੇਂ ਹੀ ਦੋ ਦੋ ਰੱਖ ਦਿਉ ਅਤੇ ਤੁਸੀਂ ਮੈਨੂੰ ਆਹ ਦੱਸ ਸਕਦੇ ਹੋ ਤੁਸੀਂ ਮੇਰਾ ਆਰਡਰ ਕਿੰਨੇ ਟਾਈਮ ਤੱਕ ਦੇਵੋਂਗੇ ਅਤੇ ਪਲੀਜ਼ ਮੈਂ ਕੋਸ਼ਿਸ਼ ਕਰਿਓ ਕਿ ਛੇਤੀ ਤੋਂ ਛੇਤੀ ਹੋ ਜਾਵੇ ਅਤੇ ਮੈਂ ਤੁਹਾਡੀ ਪੇਮੇਂਟ ਵੀ ਤੁਹਾਡੇ ਆਰਡਰ ਆਰਡਰ ਆਉਣ 'ਤੇ ਕਰ ਦੂੰਗੀ ਤੁਸੀਂ ਉਹ ਉਸੇ ਟਾਈਮ ਮੇਰਾ ਬਿੱਲ ਲਿਆ ਦਿਉ ਥੈਂਕ ਯੂ